ਅੱਜ ਕੱਲ੍ਹ ਪੰਛੀਆਂ ਦੀ ਜ਼ਿੰਦਗੀ ਵੀ ਓਨੀ ਹੀ ਜ਼ਰੂਰੀ ਹੈ ਜਿੰਨੀ ਆਦਮੀਆਂ ਦੀ ਹੈ ਐਜ ਐਜ ਇਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਪੰਛੀ ਮਰ ਰਹੇ ਸੀਗੇ ਕਿਉਂਕਿ ਧੁੱਪ ਵੀ ਬਹੁਤ ਜ਼ਿਆਦਾ ਵੱਧ ਰਹੀ ਸੀਗੀ ਅਤੇ ਅੱਜ ਕੱਲ ਫਾਈਵ ਜੀ ਨੈਟਵਰਕ ਦੇ ਹੁਣ ਸਿਗਨਲ ਵੀ ਹਾਈ ਆ ਰਹੇ ਸੀਗੇ ਪਰ ਲੋ ਲੋਕਾਂ ਨੇ ਬਹੁਤ ਕੁਛ ਆਪਣੇ ਬਗੀਚਿਆਂ ਦੇ ਵਿੱਚ ਕੀਤਾ ਪੰਛੀ ਬਚਾਉਣ ਨੂੰ ਜਿਵੇਂ ਕਿ ਜਿਵੇਂ ਕਿ ਮੈਨੂੰ ਪੰਛੀ ਬਹੁਤ ਜ਼ਿਆਦਾ ਪਸੰਦ ਆ ਉਹਦੇ ਕਾਰਨ ਮੈਂ ਆਪਣੇ ਘਰਾਂ ਵਿੱਚ ਬਹੁ ਘਰ ਦੇ ਪਿੱਛੇ ਵਾਲੇ ਵਿਹੜੇ ਵਿੱਚ ਕੁਛ ਬਹੁਤ ਕੁਝ ਰੱਖਿਆ ਹੈ ਪਹਿਲਾਂ ਤਾਂ ਸਾਰਿਆਂ ਨਾਲੋਂ ਵਧੀਆ ਚੀਜ਼ ਰੱਖੀ ਆ ਮੈਂ ਕੰਧ 'ਤੇ ਪਾਣੀ ਵਾਲਾ ਡੋਂਗਾ ਜਿਹਦੇ ਵਿੱਚ ਪੰਛੀ ਸਵੇਰੇ ਆਉਂਦੇ ਆ ਅਤੇ ਪਾਣੀ ਪੀ ਕੇ ਆਰਾਮ ਨਾਲ ਉੱਡ ਜਾਂਦੇ ਕਿਉਂਕਿ ਉਹਨਾਂ ਦਾ ਗਲਾ ਜ਼ਿਆਦਾਤਰ ਸੁੱਕ ਜਾਂਦਾ ਹੈ ਉੱਡਦੇ ਉੱਡਦੇ ਅਤੇ ਕਈ ਪੰਛੀ ਉਹਦੇ ਵਿੱਚ ਆ ਕੇ ਨਹਾ ਵੀ ਲੈਂਦੇ ਜਿਨ ਜਿਹਦੇ ਨਾਲ ਉਹਨਾਂ ਦੀ ਸਰੀਰ ਤੋਂ ਮਿੱਟੀ ਉੱਤਰ ਉੱਤਰ ਜਾਂਦੀ ਹੈ ਅਤੇ ਉਹ ਵਧੀਆ ਫੀਲ ਕਰਦੇ ਆ ਅਤੇ ਖਾਣ ਨੂੰ ਖਾਣ ਦੇ ਬਾਰੇ ਕਿਹਾ ਜਾਵੇ ਤਾਂ ਜ਼ਿਆਦਾਤਰ ਲੋਕ ਬਹੁਤ ਕੁਛ ਕਰਦੇ ਆ ਪੰਛੀਆਂ ਨੂੰ ਬਚਾਉਣ ਨੂੰ ਅਤੇ ਉਹ ਖਾਣ ਨੂੰ ਵੀ ਬਹੁਤ ਕੁਛ ਦਿੰਦੇ ਆ ਪਰ ਜਦੋਂ ਵੀ ਮੇਰੇ ਕੋਲ ਫਰੀ ਸ ਟਾਇਮ ਹੁੰਦਾ ਹੈ ਵੀਕਐਂਸ 'ਤੇ ਤਾਂ ਉਸ ਵੇਲੇ ਮੈਂ ਜ਼ਿਆਦਾਤਰ ਪੰਛੀਆਂ ਨੂੰ ਕਣਕ ਦੇ ਦਾਣੇ ਪਾ ਦਿੰਦਾ ਏ ਕਿਉਂਕਿ ਉਹਨਾਂ ਦੀ ਮਨਪਸੰਦ ਚੀਜ਼ ਆ ਜ ਜੇ ਉਹ ਕਣਕ ਦਾਣੇ ਖਾਉਗੇ ਤਾਂ ਉਹ ਜ਼ਿਆਦਾਤਰ ਹੈਲਥੀ ਰਹੂਗੇ ਅਤੇ ਉਹਨਾਂ ਨੂੰ ਐਨਰਜੀ ਵੀ ਬਹੁਤ ਵਧੀਆ ਮਿਲੇਗੀ ਅਤੇ ਕਣਕ ਦਾਣੇ ਜਿਹੜੇ ਉਹ ਉਨ੍ਹਾਂ ਲਈ ਬਹੁਤ ਹੈਲਥੀ ਆ ਅਤੇ ਪਾਣੀ ਬਗੀਚੇ ਦੇ ਵਿੱਚ ਲੋਕਾਂ ਨੇ ਘੋਂਸਲੇ ਘੋਂਸਲੇ ਵੀ ਰੱਖੇ ਹੋਏ ਆ ਘੋਂਸਲੇ ਰੱਖਣ ਦੇ ਕਾਰਨ ਕਈ ਪੰਛੀ ਜਿਹੜੇ ਹੁੰਦੇ ਆ ਰਾਤ ਨੂੰ ਧੁੰਦ ਰਾਤ ਨੂੰ ਧੁੰਦ ਬਹੁਤ ਜ਼ਿਆਦਾ ਪੈ ਜਾਂਦੀ ਹੈ ਅਤੇ ਬਾਕੀ ਜਾਨਵਰ ਵੀ ਉਹਨਾਂ 'ਤੇ ਅਟੈਕ ਕਰ ਸਕਦੇ ਹੈ ਅਤੇ ਪੰਛੀ ਜਿਹੜੇ ਹੁੰਦੇ ਨੇ ਤਕੜੇ ਨਹੀਂ ਹੁੰਦੇ ਜੇ ਉਹ ਘੋਂਸਲਿਆਂ ਦੇ ਵਿੱਚ ਰਹੂਗੇ ਤਾਂ ਉਹ ਆਰਾਮ ਨਾਲ ਆਪਣੀ ਜ਼ਿੰਦਗੀ ਨੂੰ ਵਧੀਆ ਜੀ ਲੂਗੇ ਜੇ ਜੇ ਉਹ ਘੋਂਸਲੇ ਵਿੱਚ ਰਹੂਗੇ ਤਾਂ ਉਹਨਾਂ ਨੂੰ ਕੋਈ ਚੀਜ਼ ਦੀ ਟੈਂਸ਼ਨ ਨਹੀਂ ਹੋਊਗੀ ਉਹ ਆਰਾਮ ਨਾਲ ਘੋਂਸਲੇ ਵਿੱਚ ਸੌ ਕੇ ਸਵੇਰੇ ਆਪਣੇ ਸਮੇਂ 'ਤੇ ਕਿੱਥੇ ਵੀ ਪਹੁੰਚ ਸਕਦੇ ਆ ਅੱਜ ਕੱਲ ਹਵਾ ਹਨੇਰੀ ਬਿੱਲੀਆਂ ਦਾ ਵੀ ਬਹੁਤ ਡਰ ਹੈ ਇਸ ਕਰਕੇ ਜ਼ਿਆਦਾਤਰ ਪੰਛੀ ਘੋਂਸਲਿਆਂ ਦੇ ਵਿੱਚ ਰਹਿਣਾ ਹੀ ਪਸੰਦ ਕਰਦੇ ਆ ਕਿਉਂਕਿ ਉੱਥੇ ਰਹਿ ਕੇ ਸੇਫ ਫੀਲ ਕਰੂਗੇ ਅਤੇ ਸੇਫ ਫੀਲ ਕਰੂਗੇ ਉਹਨਾਂ ਨੂੰ ਕੋਈ ਚੀਜ਼ ਦੀ ਟੈਂਸ਼ਨ ਨਹੀਂ ਹੋਊਗੀ ਅਤੇ ਅੱਜ ਕੱਲ੍ਹ ਛੋਟੇ ਛੋਟੇ ਕਬੂਤਰ ਵੀ ਆ ਜਿਨ੍ਹਾਂ ਨੂੰ ਉੱਡਣਾ ਨਹੀਂ ਆਉਂਦਾ ਪਰ ਜੇ ਉਹ ਘੋਂਸਲੇ ਦੇ ਵਿੱਚ ਰਹੂਗੇ ਅਤੇ ਉਹ ਆਰਾਮ ਨਾਲ ਸਿੱਖ ਸਕਦੇ ਆ ਅਤੇ ਲੋਕ ਮੈਂ ਸਾਰੇ ਲੋਕਾਂ ਨੂੰ ਇੱਕ ਹੀ ਬੇਨਤੀ ਕਰਦਾ ਕਿ ਜਿੰਨੇ ਵੀ ਪੰਛੀ ਹੁੰਦੇ ਉਹਨਾਂ ਨੂੰ ਦਾਣੇ ਅਤੇ ਪਾਣੀ ਪਾਇਆ ਕਰੋ ਕਿਉਂਕਿ ਉਹ ਵੀ ਐਜ਼ ਆ ਹਿਊਮਨ ਵੀਨ ਹੁੰਦੇ ਆ ਤਾਂ ਕਰਕੇ ਜੇ ਉਹਨੂੰ ਪੰਛ ਪੰਛੀ ਦਾਣੇ ਖਾਓਗੇ ਤਾਂ ਉਹ ਹਮੇਸ਼ਾ ਆਪਣੇ ਬਾਰੇ ਕੁਛ ਵਧੀਆ ਹੀ ਕਹਿ ਕੇ ਜਾਊਗੇ ਜੇ ਅੱਜ ਅਤੇ ਇਹ ਜਿਹੀਆਂ ਚੀਜ਼ਾਂ ਪਾਉਣ ਨੂੰ ਆਪਾਂ ਨੂੰ ਪੁੰਨ ਵੀ ਮਿਲੇਗਾ ਅਤੇ ਆਪਣੀ ਅੱਗੇ ਦੀ ਰਿਕਾਰਡ ਰੁਕਾਵਟਾਂ ਵੀ ਹਟ ਜਾਣਗੀਆਂ ਪੰਛੀ ਬਹੁ ਵਧੀਆ ਚੀਜ਼ ਹੁੰਦੇ ਆ ਅਤੇ ਇਸ ਲੀਏ ਉਹਨੂੰ ਸਾਂਭਿਆ ਜਾਵੇ